ਸਮੁੱਚੀ ਸਾਹ ਤੇ ਤੰਦਰੁਸਤੀ ਲਈ ਤੈਰਾਕੀ ਦੇ ਕੀ ਫਾਇਦੇ ਹਨ ਸਾਹ ਨਿਅੰਤਰਣ ਵਿੱਚ ਕਿਵੇਂ ਮਦਦ ਕਰਦਾ ਹੈ ਤੇ ਤੈਰਾਕੀ ਤੈਰਾਕੀ ਦਾ ਸਮੁੱਚੀ ਸਿਹਤ ਦੀ ਤੰਦਰੁਸਤੀ ਲਈ ਬਹੁਤ ਜਿਆਦਾ ਫਾਇਦੇ ਹਨ ਕਿਉਂਕਿ ਤੈਰਾਕੀ ਤੈਰਾਕੀ ਹੀ ਤੈਰਾਕੀ ਹੀ ਕਿਸੇ ਬਚਦੇ ਡੁੱਬਦੇ ਇਨਸਾਨ ਨੂੰ ਬਚਾ ਸਕਦੇ ਹਨ ਜਿਨਾਂ ਨੂੰ ਤੈਰਾਕੀ ਆਉਂਦੀ ਹੈ ਉਹ ਕੁਝ ਕ ਸੈਕਿੰਡਾਂ ਦੇ ਵਿੱਚ ਡੁੱਬਦੇ ਆਦਮੀ ਨੂੰ ਪਾਣੀ ਵਿੱਚੋਂ ਬਾਹਰ ਕੱਢ ਲੈਂਦੇ ਹਨ ਅਤੇ ਉਹਨਾਂ ਨੂੰ ਬਚਾਅ ਲੈਂਦੇ ਹਨ ਅਤੇ ਉਹਨਾਂ ਨੂੰ ਬਚਾਅ ਲੈਂਦੇ ਹਨ ਸਾਹ ਨਿਯੰਤਰਣ ਵਿੱਚ ਕਿਵੇਂ ਮਦਦ ਕਰਦਾ ਹੈ ਤੈਰਾਕੀ ਤੈਰਾਕੀਆਂ ਤੈਰਾਕੀਆਂ ਨੂੰ ਪਾਣੀ ਵਿੱਚ ਰਹਿਣ ਰਹਿਣ ਦਾ ਪਤਾ ਹੁੰਦਾ ਹੈ ਇਸੇ ਕਰਕੇ ਤੈਰਾਕੀ ਸਾਹ ਨਿਯੰਤਰਣ ਯਾਂ ਸਾਹ ਨਿਯੰਤਰਣ ਨੂੰ ਪਾਣੀ ਵਿੱਚ ਕੰਟਰੋਲ ਕਰਨ ਦਾ